ਭਾਰਤ ਵਿੱਚ ਕੁਝ ਸਵੇਦਨਸ਼ੀਲ ਵਿਸ਼ੇ ਹਨ ਜੋ ਵਰਜਿਤ ਹਨ ਇਹਨਾਂ ਵਿੱਚੋਂ ਕੁਝ ਇਹ ਹਨ ਧਰਮ ਅਤੇ ਧਾਰਮਿਕ ਭਾਵਨਾਵਾਂ ਧਾਰਮਿਕ ਮਾਮਲਿਆਂ 'ਤੇ ਤਿੱਖੀ ਟਿੱਪਣੀ ਜਾਂ ਮਜ਼ਾਕ ਆਮ ਤੌਰ 'ਤੇ ਸਵੀਕਾਰ ਨਹੀਂ ਕੀਤਾ ਜਾਂਦਾ ਕਿਉਂਕਿ ਇਸ ਨਾਲ ਧਾਰਮਿਕ ਭਾਵਨਾ ਨੂੰ ਠੇਸ ਪਹੁੰਚ ਸਕਦੀ ਹੈ ਰਾਸ਼ਟਰੀ ਸੁਰੱਖਿਆ ਭਾਰਤ ਦੀ ਸੁਰੱਖਿਆ ਰਾਜਨੀਤਿਕ ਰਾ ਰਣਨੀਤੀਆਂ ਅਤੇ ਰਾਜਨੀਤਿਕ ਗਤਵਿਧੀਆਂ ਨਾਲ ਸੰਬੰਧਿਤ ਜਾਣਕਾਰੀ ਦਾ ਖੁਲਾਸਾ ਕਰਨਾ ਜਾਂ ਇਸ ਉੱਤੇ ਵਾਦ ਵਿਵਾਦ ਕਰਨਾ ਅਕਸਰ ਸੈਂਸਰ ਕੀਤਾ ਜਾਂਦਾ ਹੈ ਕਸ਼ਮੀਰ ਮੁੱਦਾ ਕਸ਼ਮੀਰ ਦੇ ਮਾਮਲੇ ਬਾਰੇ ਵਿਚਾਰ ਵਟਾਂਦਰਾ ਕਈ ਵਾਰ ਸਵੈਵਾਦੀ ਅਤੇ ਸੰਵੇਦਨਸ਼ੀਲ ਸਮਝੇ ਜਾਂਦੇ ਹਨ ਇਸ ਕਰਕੇ ਉਹ ਇਸ ਉੱਤੇ ਗੰਭੀਰਤਾ ਨਾਲ ਵਿਚਾਰ ਕਰਨਾ ਪੈਂਦਾ ਹੈ ਰਾਸ਼ਟਰਵਾਦ ਅਤੇ ਦੇਸ਼ਧ੍ਰੋਹ ਕੋਈ ਵੀ ਐਸਾ ਬਿਆਨ ਜੋ ਦੇਸ਼ ਵਿਰੋਧ ਸਮਝਿਆ ਜਾ ਸਕੇ ਉਹ ਗੰਭੀਰ ਨਤੀਜਿਆਂ ਨੂੰ ਜਨਮ ਦੇ ਸਕਦਾ ਹੈ ਨਸਲ ਅਤੇ ਜਾਤੀਵਾਦੀ ਨਸਲ ਜਾਤੀ ਜਾਂ ਸਮਾਜਿਕ ਪੱਧਰ ਦੇ ਮਾਮਲਿਆਂ ਬਾਰੇ ਨਫਰਤੀ ਬੋਲਬਾਲੇ ਨੂੰ ਬਰਦਾਸ਼ਤ ਨਹੀ ਕੀਤਾ ਜਾਂਦਾ